ਹਾਂਜੀ ਹਾਂਜੀ ਸਰ ਇਦਾਂ ਪੁੱਛਣਾ ਸੀ ਜਿਵੇਂ ਪਾਸਪੋਰਟ ਬਣਾਉਣਾ ਤਾਂ ਉਸਨੂੰ ਬਣਾਉਣ ਲਈ ਕੀ ਕੀ ਲੱਗੂ ਓਕੇ ਸਰ ਮੈਂ ਇਹੀ ਪੁਛਣਾ ਸੀ ਵੀ ਡਾਕੂਮੈਂਟਸ ਲੱਗਣਗੇ ਹੋਰ ਓਕੇ ਸਰ ਸਰ ਇਹਦਾ ਪੁਛਣਾ ਸੀਗਾ ਕੀ ਤੁਹਾਡਾ ਪ੍ਰੋਸੈਸ ਕੀ ਆ ਕਿੰਨੇ ਕੁ ਮੰਥ ਤੱਕ ਚਲਾ ਜਾਂਦਾ ਹੈ ਓਕੇ ਸਰ ਇਸਦੀ ਜਦੋਂ ਇਨਕੁਆਇਰੀ ਹੁੰਦੀ ਹੈ ਤਾਂ ਉਹਦੇ ਵਿੱਚ ਕੀ ਕੀ ਚਾਹੀਦਾ ਐਂਡ ਕੀ ਕੀ ਉਹਨਾਂ ਦੇ ਰੂਲ ਆ ਮਤਲਬ ਤੁਹਾਡੇ ਓਕੇ ਸਰ ਮਤਲਬ ਜੋ ਵੀ ਤੁਸੀਂ ਉਦਾਂ ਨੋਰਮਲ ਦੱਸ ਸਕਦੇ ਹੋ ਜਿਵੇਂ ਵੀ ਬਣਾਉਣ ਲਈ ਵੀ ਅੱਗੇ ਕੋਈ ਸਰਕਾਰ ਮਤਲਬ ਕੋਈ ਲਾਉਣ ਨਾ ਦੇਣ ਇਦਾਂ ਕੁਝ ਹੁੰਦਾ ਇਹਦੇ ਵਿੱਚ ਕਿ ਨਹੀਂ

ਓਕੇ ਸਰ ਹਾਂਜੀ ਸਰ ਮੈਂ ਇਸ ਨੂੰ ਪੁੱਛ ਰਹੀ ਸੀ ਕਿ ਮੈਂ ਹੋ ਸਕਦਾ ਓਕੇ ਸਰ ਓਕੇ ਸਰ ਤਾਂ ਮਤਲਬ ਇਹ ਮੈਂ ਹਨਾ ਦੱਸ ਸਕਦੇ ਮੈਨੇ ਤੁਹਾਡਾ ਆਫਿਸ ਦਾ ਓਕੇ ਸਰ